ਜਦੋਂ ਮਸ਼ੀਨ ਧਾਗਾ ਤੋੜਨ ਲੱਗ ਜਾਏ ਤਾਂ ਇਹ ਸੰਕੇਤ ਹੁੰਦਾ ਹੈ ਕਿ ਮਸ਼ੀਨ ਦੀ ਸੈਟਿੰਗ ਵਿੱਚ ਕੁਛ ਗੜਬੜ ਹੈ ਇਸ ਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਧਾਗੇ ਦੀ ਉੱਪਰ ਅਤੇ ਹੇਠਲੀ ਤਣਾਅ ਦੀ ਜਾਂਚ ਕਰੋ ਉੱਪਰਲੇ ਧਾਗੇ ਦੀਆਂ ਤਣਾਅ ਬੈਲੈਂਸ ਕਰਨ ਲਈ ਮਸ਼ੀਨ ਦੇ ਦਿੱਤੇ ਹੋਏ ਟੈਸ਼ਨ ਨਵ ਨੂੰ ਹੌਲੀ ਹੌਲੀ ਘੁੰਮਾਓ ਅਤੇ ਹੇਠਲਾ ਧਾਗਾ ਖਿੱਚ ਰਿਹਾ ਹੈ ਤਾਂ ਬੋਬਿਨ ਦੇ ਟੈਸ਼ਨ ਚੈਕ ਨੂੰ ਹੌਲੀ ਹੌਲੀ ਢਿੱਲਾ ਜਾ ਤੀਖਾ ਕਰੋ ਇਸ ਤੋਂ ਇਲਾਵਾ ਯਕੀਨੀ ਬਣਾਓ ਕਿ ਧਾਗਾ ਠੀਕ ਤਰੀਕੇ ਨਾਲ ਪਾਸ ਹੋਇਆ ਹੈ ਅਤੇ ਸੂਈ ਵੀ ਠੀਕ ਅਤੇ ਤੇਜ਼ ਹੈ ਮਸ਼ੀਨ ਦੀ ਸਫਾਈ ਅਤੇ ਤੇਲ ਲਗਾਉਣਾ ਵੀ ਮਹੱਤਵਪੂਰਨ ਹੈ ਕਿਉਂਕਿ ਧੂੜ ਜਾਂ ਜੰਮਿਆ ਹੋਇਆ ਤੇਲ ਵੀ ਤਣਾਅ ਦੀ ਸਮੱਸਿਆ ਪੈਦਾ ਕਰ ਸਕਦਾ ਹੈ ਜੇ ਇਹ ਸਭ ਕਰਨ ਬਾਅਦ ਵੀ ਮਸ਼ੀਨ ਠੀਕ ਨਹੀਂ ਹੁੰਦੀ ਤਾਂ ਕਿਸੇ ਮਾਹਰ ਨੂੰ ਵਿਖਾ ਕੇ ਜਾਂ ਮੈਨੁਅਲ ਚੈੱਕ ਕਰਕੇ ਸੈਟਿੰਗ ਨੂੰ ਠੀਕ ਕਰੋ